ਹੈਲੋ ਸਤਿ ਸ਼੍ਰੀ ਅਕਾਲ ਜ਼ਰੂਰ ਠੀਕ ਹੈ ਮੇਰੇ ਬੇਟੇ ਨੇ ਵੀ ਨਾ ਦਸਵੀਂ ਕਲਾਸ ਦੇ ਪੇਪਰ ਦਿੱਤੇ ਆ ਮੈਂ ਦੋ ਤਿੰਨ ਸਕੂਲਾਂ 'ਚ ਜਾ ਕੇ ਪਤਾ ਕੀਤਾ ਸੀ ਐਡਮਿਸ਼ਨ ਦੇ ਬਾਰੇ ਕਿ ਉੱਥੋਂ ਦੀ ਪੜ੍ਹਾਈ ਕਿੱਦਾਂ ਦੀ ਆ ਉਥੋਂ ਦੀ ਫੀਸ ਫੂਸ ਦਾ ਕੀ ਹਿਸਾਬ ਹੈ ਸਟਾਫ ਕਿੱਦਾਂ ਦਾ ਹੈਗਾ ਮੈਨੇਜਮੈਂਟ ਕਿੱਦਾਂ ਦੀ ਜੋ ਸਕੂਲਾਂ ਜਾਣ ਤੋਂ ਬਾਅਦ ਮੈਨੂੰ ਪੀ ਸੀ ਏ ਸਕੂਲ ਥੋੜ੍ਹਾ ਬਹੁਤ ਵਧੀਆ ਲੱਗਾ ਜੀ ਇਹਨਾਂ ਦੇ ਵਿੱਚ ਸਟਾਫ ਬਹੁਤ ਵਧੀਆ ਆਉਂਦੇ ਅਤੇ ਇਹਨਾਂ ਪਲੱਸ ਵੰਨ ਟੂ ਐਤਕੀ ਸ਼ੁਰੂ ਕਰਤੀ ਇਹਨਾਂ ਨੇ ਵੀ ਹਾਂ ਮੈਨੇਜਮੈਂਟ ਵੀ ਵਧੀਆ ਹੈਗੀ ਇੱਥੋਂ ਦੀ ਟੀਚਰ ਵੀ ਕਾਫੀ ਐਜੂਕੇਟਡ ਰੱਖੇ ਨੇ ਅਤੇ ਫੀਸਾਂ ਵੀ ਦੂਜਿਆਂ ਨਾਲੋਂ ਬਹੁਤ ਘੱਟ ਹੈਗੀਆਂ ਹਿਸਾਬ ਦਾ ਹੀ ਸਾਰਾ ਕੁਝ ਠੀਕ ਠਾਕ ਵਧੀਆ ਮਾਹੌਲ ਵੀ ਚੰਗਾ ਇੱਥੋਂ ਦਾ ਬੱਚਿਆਂ ਨੂੰ ਡਿਸਪਲਨ ਵੀ ਚੰਗਾ ਸਕੂਲ ਦੇ ਵਿੱਚ ਜ਼ਰੂਰਤ ਅਤੇ ਵਧੀਆ ਸਕੂਲ ਨਹੀਂ ਕੋਈ ਦਿੱਕਤ ਨਹੀਂ ਹੈਗੀ ਬਹੁਤ ਵਧੀਆ ਸਕੂਲ ਹੈ ਨਾਲੇ ਨੇੜੇ ਹੈ ਲਾਗੇ ਵਧੀਆ ਸਕੂ ਬੱਚਿਆਂ ਨੂੰ ਆਉਣਾ ਜਾਣਾ ਸੌਖਾ ਹਾਂ ਹਾਂ ਬਿਲਕੁਲ ਪਲੱਸ ਵਨ ਉੱਥੇ ਐਡਮਿਸ਼ਨ ਕਰਾ ਰਿਹਾ ਬੱਚੇ ਦੀ ਜ਼ਰੂਰ ਕਰਾਓ ਜ਼ਰੂਰ ਕਰਾਓ ਠੀਕ ਹੈ ਜੀ